ਪੰਜਾਬ ਦਾ ਸੱਭਿਆਚਾਰ ਬਹੁਤ ਹੀ ਸੁੰਦਰ ਅਤੇ ਸੋਹਣਾ ਹੈ ਇੱਥੇ ਦੇ ਗੱਭਰੂ ਨੌਜਵਾਨ ਜਿੱਦਾਂ ਕਿ ਭੰਗੜਾ ਬਹੁਤ ਵਧੀਆ ਪਾਉਂਦੇ ਨੇ ਕਾਫ਼ੀ ਚੀਜ਼ ਕਾਫ਼ੀ ਜਿੱਦਾਂ ਛਿੰਝਾਂ ਮੇਲੇ ਹੁੰਦੇ ਨੇ ਉੱਥੇ ਵੀ ਭੰਗੜੇ ਪਾਏ ਜਾਂਦੇ ਨੇ ਕੁੜੀਆਂ ਗਿੱਧਾ ਬਹੁਤ ਸੋਹਣਾ ਪਾਉਂਦੀਆਂ ਨੇ ਜਿਸ ਤਰ੍ਹਾਂ ਕੋਈ ਵੀ ਤਿਉਹਾਰ ਹੋਵੇ ਕਿ ਤੀਆਂ ਮਨਾਈਆਂ ਜਾਂਦੀਆਂ ਨੇ ਕੁੜੀਆਂ ਸਾਵੇਂ ਖੇਡਦੀਆਂ ਨੇ ਗਿੱਧਾ ਵੀ ਕਈ ਤਰ੍ਹਾਂ ਦੇ ਪ੍ਰਚਲਿਤ ਨੇ ਪੰਜਾਬ ਦੇ ਸੱਭਿਆਚਾਰ ਵਿੱਚ ਗਿੱਧੇ ਅਤੇ ਭੰਗੜੇ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਵਿੱਚ ਜਿੱਦਾਂ ਸਾਵੇਂ ਸਾਉਣ ਦੇ ਮਹੀਨੇ ਜਿਹੜੀਆਂ ਕੁੜੀਆਂ ਦੇ ਨਵੇਂ ਵਿਆਹ ਹੋਏ ਹੁੰਦੇ ਨੇ ਉਹ ਆਪਣੇ ਪੇਕੇ ਘਰ ਆਉਂਦੀਆਂ ਨੇ ਅਤੇ ਸਾਵੇਂ ਮਨਾਉਣ ਜਾਂਦੀਆਂ ਨੇ ਉੱਥੇ ਗਿੱਧੇ ਬੋਲੀਆਂ ਬਹੁਤ ਤੀਆਂ ਮਨਾਈਆਂ ਜਾਂਦੀਆਂ ਨੇ ਪੀਘਾਂ ਝੂਟੀਆਂ ਜਾਂਦੀਆਂ ਨੇ ਗੱਭਰੂ ਨੌਜਵਾਨ ਜਿਸ ਤਰ੍ਹਾਂ ਕਾਫੀ ਵੱਖ ਵੱਖ ਛਿੰਝਾਂ ਮੇਲੇ ਹੁੰਦੇ ਨੇ ਉੱਥੇ ਭੰਗੜੇ ਪਾਉਂਦੇ ਨੇ ਇਹ ਸਾਡਾ ਪੰਜਾਬ ਦਾ ਸੱਭਿਆਚਾਰ ਹੈ ਜੋ ਕਿ ਦਿਨੋਂ ਦਿਨ ਗੁਆਚਦਾ ਜਾ ਰਿਹਾ ਉਸ ਸ ਸੰਭਾਲਣ ਦੀ ਲੋੜ ਹੈ ਵੱਧ ਤੋਂ ਵੱਧ ਸੱਭਿਆਚਾਰ ਨੂੰ ਸੰਭਾਲੋ ਕੁੜੀਆਂ ਵੀ ਗਿੱਧੇ ਨੂੰ ਪੰਜਾਬੀ ਸੱਭਿਆਚਾਰ ਕਲਚਰ ਦਾ ਧਿਆਨ ਰੱਖਣ ਕਾਫ਼ੀ ਇਹਦੇ ਵਿੱਚ ਵੱਡਾ ਯੋਗਦਾਨ ਚਾਹੀਦਾ ਹੈ ਇਸ ਕਰਕੇ ਸਾਨੂੰ ਪੰਜਾਬ ਦੇ ਸੱਭਿਆਚਾਰ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ